ਜ਼ਿੰਦਗੀ ਵਿੱਚ ਕਲਾ ਦੀ ਬਹੁਤ ਅਹਿਮੀਅਤ ਹੁੰਦੀ ਆ ਅਤੇ ਮੇਰੀ ਕਲਾ ਹੈ ਪੇਂਟਿੰਗ ਕਰਨਾ ਜਿਹਦੇ ਵਿੱਚ ਕੀ ਆ ਕਿ ਜਿਹੜੀ ਪੇਂਟਿੰਗ ਹੈ ਇਹ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਿਆ ਹੈ ਇਹਦੇ ਨਾਲ ਕੀ ਆ ਕਿ ਮੇਰੇ ਵਿੱਚ ਅੰਦਰ ਦੇ ਵਿੱਚ ਜੋ ਮਨ ਦੇ ਵਿੱਚ ਵਿਚਾਰ ਆਉਂਦੇ ਆ ਉਹ ਮੈਂ ਕੀ ਆ ਆਪਣੇ ਕਿਸੇ ਨੂੰ ਦੱਸਣ ਦੀ ਬਜਾਏ ਜਿਹੜਾ ਆਪਣੀ ਪੇਂਟਿੰਗ ਦੇ ਨਾਲ ਆਪਣੀ ਤਸਵੀਰ ਬਣਾ ਕੇ ਜਿਹੜੀ ਸਾਂਝਾ ਕਰ ਸਕਦੀ ਹਾਂ ਇਹਦੇ ਨਾਲ ਕੀ ਆ ਮੈਨੂੰ ਮਾਨਸਿਕ ਦ ਤੌਰ 'ਤੇ ਜਿਹੜੀ ਸ਼ਾਂਤੀ ਮਿਲਦੀ ਆ ਅਤੇ ਇਹਦੇ ਨਾਲ ਕੀ ਆ ਹੁਣ ਦੇਖੋ ਇਹਨੂੰ ਮੈਂ ਆਪਣਾ ਪ੍ਰੋਫੈਸ਼ਨ ਬਣਾ ਲਿਆ ਹੈ ਹੁਣ ਮੈਂ ਚਾਹੁੰਦੀ ਹਾਂ ਕਿ ਮੈਂ ਇਹਤੇ ਇਸ ਖੇਤਰ ਵਿੱਚ ਅੱਗੇ ਤੋਂ ਅੱਗੇ ਜਾਵਾਂ ਇਹਦੇ ਨਾਲ ਕੀ ਆ ਕਿ ਮੇਰਾ ਆਰਥਿਕ ਪੱਖ ਤੋਂ ਵੀ ਜਿਹੜੀ ਮੈਨੂੰ ਬੜੀ ਜਿਹੜੀ ਆ ਮਦਦ ਮਿਲਦੀ ਪਈ ਆ ਇਹਦੇ ਨਾਲ ਮੇਰੇ ਘਰ ਦਾ ਜਿਹੜਾ ਗੁਜ਼ਾਰਾ ਜਿਹੜਾ ਵਾ ਇਹਦੇ ਨਾਲ ਜਿੰਨੇ ਵੀ ਮੈਨੂੰ ਇਨਕਮ ਮਿਲਦੀ ਆ ਅਤੇ ਉਹ ਬਹੁਤ ਹੀ ਵਧੀਆ ਮੇਰੇ ਮਨ ਨੂੰ ਇੱਕ ਸ਼ਾਂਤੀ ਜਿਹੜੀ ਮਿਲਦੀ ਪਈ ਆ ਅਤੇ ਇਹਦੇ ਨਾਲ ਕੀ ਆ ਮੇਰਾ ਜੀਵਨ ਵੀ ਜਿਹੜਾ ਸੁਖਾਲਾ ਹੋ ਗਿਆ ਵਾ ਅਤੇ ਇਹਦੇ ਨਾਲ ਨਾਲ ਜਿਹੜਾ ਵਾ ਇਹਦੇ ਵਿੱਚ ਜਿੰਨੇ ਰੰਗ ਜਿਹੜੇ ਤਸਵੀਰ ਦੇ ਵਿੱਚ ਆਪਾਂ ਵਰਤਦੇ ਹਾਂ ਇਹਦੇ ਨਾਲ ਕੀ ਆ ਜ਼ਿੰਦਗੀ ਵੀ ਜਿਹੜੀ ਰੰਗੀਨ ਹੋ ਜਾਂਦੀ ਆ ਕਿਉਂਕਿ ਜਿਹੜੇ ਆਪਾਂ ਦੁੱਖ ਜਿਹੜੇ ਆ ਆਪਣੇ ਹੋਰ ਕਿਸੇ ਬੋਲ ਕੇ ਸਾਂਝੇ ਨਹੀਂ ਕਰ ਸਕਦੇ ਉਹ ਆਪਾਂ ਜਿਹੜੇ ਕੀ ਕਰਦੇ ਹਾਂ ਕਿ ਇਸ ਤਸਵੀਰ ਦੇ ਰਾਹੀਂ ਜਿਹੜੇ ਆਪਾਂ ਆਪਣੇ ਬਿਆਨ ਕਰ ਸਕਦੇ ਹਾਂ